ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਫੋਟੋਗ੍ਰਾਫੀ ਜਾਨੀ ਕਿ ਤਸਵੀਰਾਂ ਖਿੱਚਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਹ ਮੇਰੀ ਪਹਿਲੀ ਹੋਬੀ ਦੇ ਵਿੱਚ ਇਹ ਖੂਬੀ ਹੈ ਜੇ ਆਪਾਂ ਗੱਲ ਕਰੀਏ ਤਸਵੀਰਾਂ ਦੀ ਤਾਂ ਮੈਂ ਕੁਦਰਤ ਦੀਆਂ ਅਤੇ ਕੁਦਰਤ ਨਾਲ ਜੁੜੀ ਹੋਈ ਹਰ ਚੀਜ਼ ਦੀਆਂ ਤਸਵੀਰਾਂ ਖਿੱਚਣੀਆਂ ਪਸੰਦ ਕਰਦਾ ਹਾਂ ਮੈਂ ਤਸਵੀਰਾਂ ਖਿੱਚਣੀਆਂ ਪਸੰਦ ਕਰਦਾ ਹਾਂ ਉਹ ਦਰਖਤਾਂ ਦੀਆਂ ਉਹ ਪੌਦਿਆਂ ਦੀਆਂ ਜੋ ਕਿ ਆਪਣੇ ਆਪ ਵਿਚ ਹਰੇ ਭਰੇ ਅਤੇ ਬਹੁਤ ਖੂਬਸੂਰਤ ਹੁੰਦੇ ਹਨ ਮੈਂ ਤਸਵੀਰਾਂ ਖਿਚਣੀਆਂ ਪਸੰਦ ਕਰਦਾ ਹਾਂ ਉਹ ਜਾਨਵਰਾਂ ਦੀਆਂ ਜੋ ਕਿ ਕੁਦਰਤ ਨਾਲ ਜੁੜੇ ਹੁੰਦੇ ਹਨ ਅਤੇ ਦੇਖਣ ਵਿੱਚ ਵੀ ਬਹੁਤ ਹੀ ਸੁੰਦਰ ਹੁੰਦੇ ਹਨ

ਜਾਂ ਫਿਰ ਤਸਵੀਰਾਂ ਖਿੱਚਣੀਆਂ ਪਸੰਦ ਕਰਦਾ ਹਾਂ ਆਪਣੀ ਬੇਟੀ ਦੀਆਂ ਮੈਨੂੰ ਉਸ ਦੇ ਹਰ ਮੂਵਮੈਂਟ ਨੂੰ ਕੈਮਰੇ ਵਿੱਚ ਕੈਦ ਕਰਨਾ ਪਸੰਦ ਹੈ ਉਸ ਦੇ ਜੰਮਣ ਤੋਂ ਲੈ ਕੇ ਅੱਜ ਪੰਜ ਸਾਲ ਤੱਕ ਮੈਂ ਉਸ ਦੀਆਂ ਲੱਖਾਂ ਤਸਵੀਰਾਂ ਖਿੱਚ ਚੁੱਕਾ ਹਾਂ ਅਤੇ ਆਪਣੇ ਕੈਮਰੇ ਵਿੱਚ ਕੈਦ ਕਰ ਚੁੱਕਿਆ ਹਾਂ ਜੋ ਕਿ ਮੈਨੂੰ ਬਹੁਤ ਪਸੰਦ ਹਨ ਜੋ ਤਸਵੀਰਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਹਨ ਮੈਂ ਉਹਨਾਂ ਨੂੰ ਕਾਗਜ਼ ਪਰ ਉਤਾਰ ਕੇ ਆਪਣੇ ਘਰ ਦੀ ਕੰਧ ਉੱਪਰ ਜੜ੍ਹ ਕੇ ਇਹ ਖੁਸ਼ੀ ਮਹਿਸੂਸ ਕਰਦਾ ਹਾਂ ਜੋ ਕਿ ਦੇਖਣ ਵਿੱਚ ਬਹੁਤ ਸੁੰਦਰ ਲੱਗਦੀ ਹੈ ਮੈਨੂੰ ਤਸਵੀਰਾਂ ਖਿੱਚਣੀਆਂ ਪਸੰਦ ਹਨ ਹਰ ਉਹ ਵਸਤੂ ਦੀ ਜੋ ਦੇਖਣ ਵਿੱਚ ਅਲੱਗ ਲੱਗਦੀ ਹੈ ਮੈਨੂੰ ਆਪਣੇ ਕੈਮਰੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕੈਮਰੇ ਨੂੰ ਸਾਂਭ ਕੇ ਰੱਖਣਾ ਉਸ ਦੀ ਸਫਾਈ ਕਰਨਾ ਅਤੇ ਉਸ ਨਾਲ ਤਸਵੀਰਾਂ ਖਿੱਚਣੀਆਂ ਮੇਰੀ ਇੱਕ ਹੋਬੀ ਹੈ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਮੈਂ ਹਰ ਉਸ ਵਸਤੂ ਦੀ ਤਸਵੀਰ ਖਿੱਚਣੀ ਚਾਹੁੰਦਾ ਹਾਂ ਜੋ ਕਿ ਦੇਖਣ ਵਿੱਚ ਅਲੱਗ ਲੱਗਦੀ ਹੈ ਅਤੇ ਮਨਮੋਹਕ ਹੁੰਦੀ ਹੈ ਧੰਨਵਾਦ